ਮੈਨੂੰ ਬਾਈਕਿੰਗ ਦਾ ਜਨੂੰਨ ਬਹੁਤ ਛੋਟੇ ਹੁੰਦਿਆਂ ਤੋਂ ਹੀ ਹੋ ਗਿਆ ਸੀ ਕਿਉਂਕਿ ਜਦ ਵੀ ਮੈਂ ਟੀ ਵੀ ਦੇਖਦਾ ਸੀ ਕੋਈ ਨਾ ਕੋਈ ਫਿਲਮਾਂ ਦੇਖਦਾ ਸੀ ਜਾਂ ਹੋਰ ਕੋਈ ਪ੍ਰੋਗਰਾਮ ਦੇਖਦਾ ਸੀ ਤਾਂ ਬਾਈਕਿੰਗ ਦੇਖ ਕੇ ਮੈਨੂੰ ਬਹੁਤ ਹੀ ਚਲਾਉਣ ਦਾ ਮਨ ਕਰਦਾ ਸੀ ਜਦ ਦੋ ਹਜ਼ਾਰ ਚਾਰ ਵਿੱਚ ਧੂਮ ਫਿਲਮ ਆਈ ਤਾਂ ਉਸ ਦੇ ਵਿੱਚ ਵਰਤੀ ਗਈ ਬਾਈਕ ਹਾਯਾਬੁਸਾ ਨੇ ਮੈਨੂੰ ਬਹੁਤ ਹੀ ਪ੍ਰੇਰਿਤ ਕੀਤਾ ਉਸ ਤੋਂ ਮੈਨੂੰ ਬਾਈਕ ਚਲਾਉਣ ਦਾ ਮਨ ਹੋਰ ਜ਼ਿਆਦਾ ਵੱਧ ਗਿਆ ਅਤੇ ਫਿਰ ਜਦੋਂ ਮੈਂ ਆਪਣੀ ਬਾਰ੍ਹਵੀਂ ਕਲੀਅਰ ਕੀਤੀ ਤਾਂ ਤਾਂ ਮੈਨੂੰ ਨਵੀਂ ਬਾਈਕ ਮਿਲੀ ਜਿਸ ਜਿਸ 'ਤੇ ਮੈਂ ਬਹੁਤ ਹੀ ਜ਼ਿਆਦਾ ਇੰਜੋਏ ਕਰਦਾ ਰਿਹਾ ਵੱਖ ਵੱਖ ਜਗ੍ਹਾ 'ਤੇ ਆਪਣੇ ਦੋਸਤਾਂ ਨਾਲ ਜਾਂਦਾ ਰਿਹਾ ਅਤੇ ਮੈਨੂੰ ਬਾਈਕਿੰਗ ਦਾ ਸ਼ੌਂਕ ਹੋਰ ਜ਼ਿਆਦਾ ਵੱਧ ਗਿਆ ਹੁਣ ਵੀ ਮੈਨੂੰ ਜਦੋਂ ਵੀ ਆਫਿਸ ਤੋਂ ਛੁੱਟੀ ਮਿਲਦੀ ਹੈ ਤਾਂ ਮੈਂ ਆਪਣੇ ਦੋਸਤ ਨਾਲ ਬਾਈਕਿੰਗ 'ਤੇ ਨਿਕਲ ਜਾਂਦਾ ਹਾਂ ਮੈਂ ਬ ਬਾਈਕਿੰਗ 'ਤੇ ਬਹੁਤ ਹੀ ਜ਼ਾ ਅਲੱਗ ਅਲੱਗ ਟੂਰ ਕੀਤੇ ਹਨ ਜਿਵੇਂ ਕਿ ਲੇਹ ਲਦਾਖ ਜਾਂ ਹਿਮਾਚਲ ਵਗੈਰਾ ਦੇ ਅਤੇ ਮੈਨੂੰ ਬਾਈਕਿੰਗ ਦਾ ਸ਼ੌਂਕ ਬਹੁਤ ਇਸੇ ਤਰ੍ਹਾਂ ਹੀ ਬਹੁਤ ਰਹਿੰਦਾ ਹੈ ਮੈਨੂੰ ਜਦ ਵੀ ਮੌਕਾ ਮਿਲਦਾ ਹੈ ਟਾਈਮ ਮਿਲਦਾ ਹੈ ਤਾਂ ਮੈਂ ਕਿਤੇ ਨਾ ਕਿਤੇ ਟ੍ਰਿਪ 'ਤੇ ਜਾਂਦਾ ਹਾਂ